ਭੰਗੜੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਇਸ ਦੀ ਜ਼ਿਆਦਾਤਰ ਮਹੱਤਤਾ ਪੰਜਾਬ ਦੇ ਲੋਕ ਗੀਤਾਂ ਨਾਲ ਜੁੜੀ ਹੋਈ ਹੈ ਪਰ ਅੱਜ ਕੱਲ੍ਹ ਭੰਗੜਾ ਵਿਸ਼ਵ ਦੇ ਹਰ ਪੱਖ ਵਿੱਚ ਵਿੱਚ ਬਹੁਤ ਪ੍ਰਸਿੱਧ ਹੋਇਆ ਹੋਇਆ ਹੈ ਇਸ ਵਿੱਚ ਇਸ ਵਿੱਚ ਬਹੁਤ ਲੋਕਾਂ ਨੇ ਮਹਾਨਤਾ ਹਾਸਿਲ ਕੀਤੀ ਹੈ ਪੰਜਾਬ ਦੇ ਬਹੁਤ ਸੇ ਲੋਕਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਸ ਵਿੱਚ ਮਹਾਨਤਾ ਹਾਸਿਲ ਕੀਤੀ ਹੈ